ਬਾਈਕਿੰਗ ਗੇਅਰ ਦਾ ਸਾਜੋ ਸਮਾਨ ਦੇ ਕੁਛ ਸਭ ਤੋਂ ਮਹੱਤਵਪੂਰਨ ਟੁਕੜੇ ਹੈ ਕਿ ਜਿਵੇਂ ਮੈਂ ਆਪਣੇ ਨਾਲ ਹਮੇਸ਼ਾ ਆਪਣੀ ਗੱਡੀ ਦੇ ਪੂਰੇ ਕਾਗਜ਼ਾਤ ਕੈਰੀ ਕਰਦਾ ਹਾਂ ਨਾਲ ਹੀ ਇਸ ਦੀ ਟੂਲ ਕਿੱਟ ਜ਼ਰੂਰ ਰੱਖਦਾ ਹਾਂ ਤਾਂ ਕਿ ਮੈਨੂੰ ਕਿਤੇ ਵੀ ਰਸਤੇ ਦੇ ਵਿੱਚ ਦਿੱਕਤ ਆਉਣ 'ਤੇ ਘੱਟੋ ਘੱਟ ਮਕੈਨਿਕ ਤੱਕ ਲਿਜਾਉਣ ਲਈ ਕੋਈ ਹੋਰ ਦਿੱਕਤ ਨਾ ਆਵੇ ਤੀਸਰਾ ਮੈਂ ਆਪਣੇ ਨਾਲ ਫਸਟ ਏਡ ਦਾ ਸਮਾਨ ਵੀ ਜ਼ਰੂਰ ਕੈਰੀ ਕਰਦਾ ਹਾਂ ਤਾਂ ਕਿ ਕਿਤੇ ਉ ਉੱਨੀ ਇੱਕੀ ਹੋ ਜਾਵੇ ਤਾਂ ਮੈਨੂੰ ਆਪਣਾ ਜਿਹੜਾ ਥੋੜ੍ਹਾ ਬਹੁਤਾ ਪੱਟੀ ਪੱਟੀ ਕਿਸੇ ਨੂੰ ਮਾੜੀ ਮੋਟੀ ਸੱਟ ਲੱਗਣ 'ਤੇ ਕਰ ਲਵਾਂ ਦੂਸਰਾ ਹੈ ਕਿ ਆਪਣੀ ਮਕੈਨਿਕ ਸਮੱਸਿਆਵਾਂ ਦਾ ਪ੍ਰਬੰਧ ਕਿਵੇਂ ਕਰਦੇ ਹੋ ਮੈਂ ਆਪਣੀ ਮਕੈਨਿਕ ਸਮੱਸਿਆਵਾਂ ਦਾ ਪ੍ਰਬੰਧ ਇਸ ਤਰ੍ਹਾਂ ਕਰਦਾ ਹਾਂ ਕਿ ਜੇ ਮੈਂ ਕਿਤੇ ਮੇਰੀ ਰਸਤੇ 'ਚ ਬਾਈਕ ਖ਼ਰਾਬ ਹੋ ਜਾਂਦੀ ਹੈ ਤਾਂ ਮੈਂ ਪਹਿਲੇ ਉਹਨੂੰ ਧੱਕਾ ਮਾਰ ਕੇ ਕਿਤੇ ਕੋਲ ਲਾਗੇ ਕਿਸੇ ਬੰਦੇ ਨੂੰ ਲੋਕਲ ਨੂੰ ਪੁੱਛ ਕੇ ਆਪਣਾ ਜਿਹੜਾ ਹੈ ਮੋਟਰਸਾਈਕਲ ਦੀ ਰਿਪੇਅਰ ਕਰਵਾਉਂਦਾ ਹਾਂ ਅਗਰ ਨਹੀਂ ਮਿਲਦਾ ਲਾਗੇ ਤਾਂ ਫਿਰ ਮੈਂ ਗੂਗਲ ਦੇ ਥਰੂ ਵੀ ਕਿਸੇ ਨੰਬਰ ਦੀ ਪੜਤਾਲ ਕਰਦਾ ਹਾਂ ਉੱਥੇ ਹੀ ਮੈਨੂੰ ਕੋਈ ਨਾ ਕੋਈ ਨੰਬਰ ਜ਼ਰੂਰ ਮਿਲ ਜਾਂਦਾ ਹੈ ਜਿਸ ਨਾਲ ਮੈਂ ਆਪਣਾ ਬਾਈਕ ਠੀਕ ਕਰਵਾ ਲੈਂਦਾ ਹਾਂ ਇੱਕ ਵਾਰ ਮੈਂ ਯਾਤਰਾ ਦੌਰਾਨ ਵੀ ਸਾਈਕਿਲ ਮੋਟਰਸਾਈਕਲ ਦੇ ਵਿੱਚ ਫਸ ਗਿਆ ਸੀ ਉੱਥੇ ਮੈਂ ਆਪਣਾ ਸਾਈਕਲ ਦੇ ਨਾਲ ਉੱਤੇ ਜਾ ਰਿਹਾ ਸੀ ਅਤੇ ਰਸਤੇ ਦੇ ਵਿੱਚ ਫਸ ਜਾਣ ਕਰਕੇ ਮੈਨੂੰ ਘੱਟੋ ਘੱਟ ਡੇਢ ਦੋ ਕਿਲੋਮੀਟਰ ਆਪਣਾ ਸ ਮੋਟਰਸਾਈਕਲ ਰੇੜਨਾ ਪਿਆ ਬਾਅਦ ਦੇ ਵਿੱਚ ਮੈਂ ਉਹਨੂੰ ਕਿਸੇ ਮਕੈਨਿਕ ਕੋਲ ਪਹੁੰਚ ਕੇ ਠੀਕ ਕਰਵਾਇਆ